ਅੰਮ੍ਰਿਤਸਰ ਵਿੱਚ ਭੋਜਨ ਮਸ਼ਹੂਰ ਹਨ ਵੈਸੇ ਤਾਂ ਕੁੱਝ ਭੋਜਨ ਲਈ ਪ੍ਰਸਿੱਧ ਹਨ ਜਿਵੇਂ ਕਿ ਅੰਮ੍ਰਿਤਸਰੀ ਕੁਲਚੇ ਸ਼ਾਹੀ ਪਨੀਰ ਚਿਕਨ ਸਬਜ਼ੀ ਦਾਲ ਮੱਖਣੀ ਛੋਲੇ ਭਟੂਰੇ ਪਨੀਰ ਟਿੱਕਾ ਦੁੱਧ ਅਤੇ ਜਲੇਬੀਆਂ ਅੰਮ੍ਰਿਤਸਰ ਮੱਕੀ ਦੀ ਰੋਟੀ ਅਤੇ ਸਾਗ ਇਹਨਾਂ ਨੂੰ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਮੱਗਰੀਆਂ ਦੀ ਲੋੜ ਪੈਂਦੀ ਹੈ ਪਹਿਲਾਂ ਤੋਂ ਇਹਨਾਂ ਲਈ ਬਰਤਨ ਚਾਹੀਦੇ ਹਨ ਸਾਗ ਲਈ ਸਰ੍ਹੋਂ ਅਤੇ ਪਾਲਕ ਚਾਹੀਦੀ ਹੈ ਸਾਗ ਪਨੀਰ ਅਤੇ ਪਿਆਜ਼ ਅਤੇ ਕਈ ਤਰ੍ਹਾਂ ਦੇ ਮਸਾਲੇ ਮਿਕਸ ਸਬਜ਼ੀ ਲਈ ਕਾਫ਼ੀ ਸਬਜ਼ੀਆਂ ਦੀ ਲੋੜ ਪੈਂਦੀ ਹੈ ਇਤਿਹਾਸ ਵਿੱਚ ਇਹਨਾਂ ਦਾ ਕਾਫ਼ੀ ਯੋਗਦਾਨ ਹੈ ਖਾਣਾ ਖਾਣ ਲਈ ਕਾਫ਼ੀ ਹੋਟਲ ਹਨ ਇਤਿਹਾਸ ਵਿੱਚ ਇਹਨਾਂ ਦੀ ਕਾਫ਼ੀ ਮਹੱਤਤਾ ਹੈ